ਸਾਡੇ ਸਭ ਤੋਂ ਨੇੜੇ ਧਾਰਮਿਕ ਅਸਥਾਨ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਹੈ ਅਤੇ ਅਸੀਂ ਇੱਥੇ ਨਿਤ ਅੰਮ੍ਰਿਤ ਵੇਲੇ ਜਾਂਦੇ ਹਾਂ ਅਤੇ ਉੱਥੇ ਜਾ ਕੇ ਨਤਮਸਤਕ ਹੁੰਦੇ ਹਾਂ ਗੁਰੂ ਜੀ ਦੀ ਹਾਜ਼ਰੀ ਦੇ ਵਿੱਚ ਬੈਠਦੇ ਹਾਂ ਅਤੇ ਉੱਥੋਂ ਦੀ ਬਾਣੀ ਸੁ ਬਾਣੀ ਅਤੇ ਪਾਠ ਸੁਣਦੇ ਹਾਂ ਜਿਸ ਵਿੱਚ ਸਾਨੂੰ ਬਹੁਤ ਆਨੰਦ ਹੁੰਦਾ ਹੈ ਅਤੇ ਮਨ ਵੀ ਸ਼ਾਂਤ ਹੁੰਦਾ ਹੈ ਅਸੀਂ ਗੁਰੂ ਜੀ ਦੇ ਨਾਲ ਜੁੜਦੇ ਹਾਂ ਅਤੇ ਉਨ੍ਹਾਂ ਦੀ ਬਾਣੀ ਸੁਣਦੇ ਹਾਂ ਅਤੇ ਅਮਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬਾਣੀ ਸਾਨੂੰ ਬਹੁਤ ਕੁਝ ਸਿੱਖਿਆ ਦਿੰਦੀ ਹੈ ਬਾਣੀ ਸਾਨੂੰ ਕਿਵੇਂ ਅਸੀਂ ਬਾਹਰ ਵਿਚਰਨਾ ਹੈ ਕਿਵੇਂ ਲੋਕਾਂ ਦੇ ਨਾਲ ਰਹਿਣਾ ਹੈ ਅਤੇ ਸਭ ਨਾਲ ਇੱਕੋ ਹੀ ਵਿਹਾਰ ਕਰਨਾ ਹੈ ਅਤੇ ਪੰਗਤ 'ਚ ਬੈਠ ਕੇ ਪੰਗਤ 'ਚ ਬੈਠ ਕੇ ਰੋਟੀ ਪਾਣੀ ਛਕਣੀ ਹੈ ਬਾਣੀ ਇਸ ਬਾਣੀ ਸੁਣਦਿਆਂ ਸਾਨੂੰ ਬਹੁਤ ਆਨੰਦ ਆਉਂਦਾ ਹੈ ਅਤੇ ਮਨ ਵੀ ਪਵਿੱਤਰ ਅਤੇ ਸ਼ਾਂਤ ਹੁੰਦਾ ਹੈ